ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਅਕਟੂਬਰ ਉੱਨੀ ਸੌ ਚੁਰੰਜਾ ਵੀਹ ਫਰਵਰੀ ਦੋ ਹਜ਼ਾਰ ਗਿਆਰ੍ਹਾਂ ਉਣੱਤੀ ਮਈ ਦੋ ਹਜ਼ਾਰ ਬਾਰ੍ਹਾਂ ਸੋਲ੍ਹਾਂ ਜਨਵਰੀ ਦੋ ਹਜ਼ਾਰ ਛੇ